ਅੱਜ ਕੱਲ੍ਹ ਲੋਕਾਂ ਦੇ ਵਿੱਚ ਕੀ ਆ ਡਾਂਸ ਨੂੰ ਲੈ ਕੇ ਬਹੁਤ ਮਤਲਬ ਕਰੇਜ਼ ਹੈਗਾ ਕਿਉਂਕਿ ਲੋਕ ਜਿੱਥੇ ਕਿ ਆ ਜਿੰਮ ਕਰਦੇ ਨੇ ਵਰਕਆਊਟ ਕਰਦੇ ਨੇ ਉੱਥੇ ਕੀ ਆ ਅੱਜ ਕੱਲ੍ਹ ਲੋਕ ਇਹ ਸੋਚਣ ਲੱਗ ਗਏ ਵੀ ਅਗਰ ਅਸੀਂ ਵਰਕਆਊਟ ਕਰਨਾ ਹੀ ਹੈ ਤਾਂ ਅਸੀਂ ਕੁਛ ਮਤਲਬ ਖਾਸ ਸਿੱਖ ਕੇ ਕਰੀਏ ਤਾਂ ਉਹ ਕੀ ਹੈ ਡਾਂਸ ਵੱਲ ਜਾ ਰਹੇ ਹੈ ਉਹ ਡਾਂਸ ਭਾਵੇਂ ਭੰਗੜਾ ਹੋਵੇ ਕੱਥਕ ਹੋਵੇ ਜਾਂ ਗਿੱਧਾ ਹੋਵੇ ਕੋਈ ਵੀ ਹੋਵੇ ਅੱਜ ਕੱਲ੍ਹ ਲੋਕ ਮਤਲਬ ਕਿ ਸਾਰੇ ਹੀ ਡਾਂਸ ਮਤਲਬ ਸਾਰੇ ਤਰ੍ਹਾਂ ਦਾ ਡਾਂਸ ਸਿੱਖਣ 'ਚ ਕੀ ਆ ਆਪਣੀ ਦਿਲਚਸਪੀ ਲੈਂਦੇ ਨੇ ਉਹਦੇ ਨਾਲ਼ ਕੀ ਹੈ ਉਹਨਾਂ ਨੂੰ ਕੀ ਹੈ ਆਪਣੇ ਨਾਲ਼ ਤਾਂ ਉਹਨਾਂ ਦਾ ਮਤਲਬ ਕਿ ਸਿਹਤ ਦਾ ਕੀ ਹੈ ਉਹ ਸਹੀ ਰਹਿੰਦਾ ਮਤਲਬ ਵਰਕਆਊਟ ਹੋ ਜਾਂਦਾ ਅਤੇ ਨਾਲ਼ ਦੀ ਨਾਲ਼ ਉਹਨਾਂ ਦੇ ਵਿੱਚ ਇੱਕ ਹੈ ਟੈਲੈਂਟ ਉੱਭਰ ਕੇ ਆਉਂਦਾ ਜਿਹਦੇ ਨਾਲ਼ ਕੀ ਹੈ ਉਹ ਆਪਣਾ ਅੱਗੇ ਅੱਜ ਕੱਲ੍ਹ ਲੋਕ ਇਸ ਦਾ ਰੁਜ਼ਗਾਰ ਵੀ ਇਹਨੂੰ ਲੈ ਕੇ ਮਤਲਬ ਅੱਗੇ ਤੋਰ ਰਹੇ ਨੇ ਜਿਹਦੇ ਜਿਵੇਂ ਕਿ ਮੇਨਲੀ ਅੱਜ ਕੱਲ੍ਹ ਜਿਹੜਾ ਮਤਲਬ ਕਰੇਜ਼ ਦੇ ਵਿੱਚ ਡਾਂਸ ਹੈਗਾ ਉਹ ਕੀ ਹੈ ਭੰਗੜਾ ਹੈਗਾ ਲੋਕ ਇਸ 'ਤੇ ਕੀ ਹੈ ਆਪਣੀਆਂ ਵੀਡੀਓਜ਼ ਬਣਾ ਰਹੇ ਨੇ ਅਤੇ ਕੀ ਹੈ ਭੰਗੜੇ ਦਾ ਕਰੇਜ਼ ਅੱਜ ਕੱਲ੍ਹ ਪੂਰੇ ਭਾਰਤ ਦੇ ਵਿੱਚ ਕੀ ਹੈ ਜਿਹੜਾ ਜਾ ਰਿਹਾ ਕਿਉਂਕਿ ਪੰਜਾਬੀ ਜਿਹੜੇ ਆਪਣਾ ਮਤਲਬ ਭੰਗੜਾ ਕੀ ਹੈ ਇੰਨਾਂ ਐਨਰਜੀ ਵਾਲਾ ਡਾਂਸ ਹੈਗਾ ਮਤਲਬ ਮ ਉਹ ਡਾਂਸ ਹੈਗਾ ਜਿਹਦੇ ਨਾਲ਼ ਕੀ ਹੈ ਲੋਕ ਕੀ ਹੈ ਆਪਣਾ ਪ੍ਰੋਪਰ ਵਰਕਆਊਟ ਹੈ ਜਿਹੜਾ ਉਹ ਕਰਦੇ ਨੇ ਜਿਹਦੇ ਨਾਲ਼ ਉਹਨਾਂ ਦਾ ਕੀ ਹੈ ਮਤਲਬ ਪੂਰੀ ਅ ਬੋਡੀ ਦੀ ਐਨਰਜੀ ਆ ਜਿਹੜੀ ਉਹ ਯੂਜ਼ ਹੁੰਦੀ ਹੈ ਅਤੇ ਕੀ ਹੈ ਆਪਣਾ ਮਤਲਬ ਕਿ ਮ ਪੂਰਾ ਬੋਡੀ ਸਟਕਚਰ ਉਹਨਾਂ ਦਾ ਸਹੀ ਰਹਿੰਦਾ ਜਿਸ ਦੇ ਕਾਰਨ ਕੀ ਹੈ ਅੱਜ ਕੱਲ੍ਹ ਜਿਹੜਾ ਕਰੇਜ਼ ਹੈਗਾ ਜਿਹੜਾ ਜ਼ਿਆਦਾ ਪਸੰਦ ਕਰਨਾ ਕਰਿਆ ਜਾਣ ਵਾਲਾ ਡਾਂਸ ਹੈ ਉਹ ਭੰਗੜਾ ਹੈ